ਗੁਡ ਮੋਰਨਿੰਗ ਮੈਮ ਫਿਸ਼ ਮਿਲ ਸਕਦੀ ਆ ਹੈ ਡਿਲੀਵਰੀ ਚਾਰਜ ਹੈ ਮੈਮ ਕੱਲ੍ਹ ਸ਼ਾਮੀ ਚਾਹੀਦੀ ਹੈ ਹੈਲੋ ਰੈਸਪੀ ਕੀ ਹੈ ਮੈਮ ਹਾਂਜੀ ਹਾਂਜੀ ਹਾਂਜੀ ਫਿਸ਼ ਬਿ ਫਿਸ਼ ਬਿਰਿਆਨੀ ਦੇ ਦਿਓ ਮੈਮ ਦੋ ਕੇਜੀ ਹਾਂਜੀ ਮੈਮ ਕੱਲ੍ਹ ਸ਼ਾਮ ਤੱਕ ਹਾਂਜੀ ਹਾਂਜੀ ਹਾਂਜੀ ਓਕੇ ਅਤੇ ਹੋਰ ਕੀ ਕੀ ਆਫਰ ਹੈ ਮੈਮ ਹਾਂਜੀ ਓਕੇ ਰੈਸਪੀ ਕੀ ਹੈ ਮੈਮ ਹਾਂਜੀ ਹਾਂਜੀ ਹਾਂਜੀ ਹੋਰ ਮੈਮ ਕਦੋਂ ਤੱਕ ਡਿਲੀਵਰ ਕਰ ਸਕਦੇ ਹੋ ਮੈਮ ਓਕੇ ਦੋ ਕੇਜੀ ਫਿਸ਼ ਚਾਹੀਦੀ ਆ ਮੈਮ ਐਗ ਵਗੈਰਾ ਵੀ ਅਵੇਲੇਬਲ ਹੈਗੇ ਆ ਮੈਮ ਉਸ 'ਚ ਕੀ ਕੀ ਆ ਮੈਮ ਉਸ 'ਚ ਕੀ ਕੀ ਵਰਾਈਟੀ ਹੈ ਹਾਂਜੀ ਹਾਂਜੀ ਦੱਸਿਓ ਹੋਰ ਕੀ ਕੀ ਵਰਾਈਟੀ ਹੈ ਹਾਂਜੀ ਹੈਲੋ ਮੈਮ ਮੈਨੂੰ ਦੋ ਕੇਜੀ ਟਰੇਅ ਚਾਹੀਦੀਆਂ ਐੱਗ ਦੀਆਂ ਦੋ ਕੇਜੀ ਟਰੇਅ ਚਾਹੀਦੀਆਂ ਐੱਗ ਦੀਆਂ ਅਵਲੇ ਹਾਂਜੀ ਅਵੇਲੇਬਲ ਹੈ ਚਿਕਨ ਪੀਜ਼ਾ ਐੱਗ ਪੀਜ਼ਾ ਅਵੇਲੇਬਲ ਹੈ ਮੈਮ ਤੁਹਾਡੇ ਰੈਸਟੋਰੈਂਟ ਦਾ ਕੀ ਨਾਮ ਹੈ ਮੈਮ ਹੈਲੋ